ਸਾਡੇ ਪਿੰਡ ਵਿੱਚ ਕਾਫੀ ਲੋਕਾਂ ਨੇ ਸਬਜ਼ੀ ਬੀਜਣ ਦੇ ਧੰਦੇ ਨੂੰ ਸ਼ੁਰੂ ਕੀਤਾ ਇਸ ਧੰਦੇ ਨਾਲ ਉਹਨਾਂ ਨੂੰ ਮੁਨਾਫਾ ਤਾਂ ਚੰਗਾ ਹੋਣਾ ਹੀ ਸੀ ਨਾਲ ਉਹ ਮਿਹਨਤ ਵੀ ਕਰਦੇ ਸੀ ਸਰੀਰ ਪੱਖੋਂ ਠੀਕ ਰਹਿੰਦੇ ਆ ਅਤੇ ਤਾਜ਼ੀ ਸਾਫ ਪਾਣੀ ਦੀ ਸਬਜ਼ੀ ਬੀਜ ਕੇ ਔਰਗੈਨਿਕ ਸਬਜ਼ੀ ਬੀਜ ਕੇ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਆ ਸਬਜ਼ੀ ਉਹਨਾਂ ਨੂੰ ਬਚ ਜਾਂਦੀ ਸੀ ਘਰ ਦੀ ਸਬਜ਼ੀ ਫਰੀ ਰਹਿ ਜਾਂਦੀ ਸੀ ਅਤੇ ਜੋ ਸਬਜ਼ੀ ਲੱਗਦੀ ਸੀ ਉਸਨੂੰ ਬਾਜ਼ਾਰ ਜਾ ਕੇ ਜਾਂ ਰੇਹੜੀਆਂ ਲਾ ਕੇ ਵੇਚਦੇ ਸੀ ਅਤੇ ਉਹਨਾਂ ਨੂੰ ਚੰਗਾ ਮੁਨਾਫਾ ਹੁੰਦਾ ਸੀ ਇਸ ਤਰ੍ਹਾਂ ਇੱਕ ਦੂਸਰੇ ਨੂੰ ਦੇਖਦੇ ਦੇਖਦੇ ਕਾਫੀ ਲੋਕ ਸਬਜ਼ੀ ਬੀਜਣ ਦੇ ਧੰਦੇ ਨੂੰ ਸ਼ੁਰੂ ਕਰਨ ਲੱਗੇ ਅਤੇ ਇਸ ਤੋਂ ਚੰਗਾ ਮੁਨਾਫਾ ਆਉਂਦਾ ਹੈ